ਸਾਡੇ ਪੰਜਾਬੀ ਸੱਭਿਆਚਾਰ ਵਿੱਚ ਗੱਭਰੂ ਕੁੜਤਾ ਚਾਦਰਾ ਲਗਾਉਂਦੇ ਹਨ ਅਤੇ ਇਸ ਤੋਂ ਇਲਾਵਾ ਉਹ ਗਲ਼ ਵਿੱਚ ਕੈਂਠਾ ਅਤੇ ਤੁਰਲੇ ਵਾਲੀ ਪੱਗ ਬੰਨਦੇ ਹਨ ਜਦ ਕਿ ਮੁਟਿਆਰਾਂ ਉਹ ਉਹਨਾਂ ਦਾ ਪਹਿਰਾਵਾ ਪੰਜਾਬੀ ਸੂਟ ਗਹਿਣੇ ਫੁਲਕਾਰੀ ਪੰਜਾਬੀ ਜੁੱਤੀ ਆਦਿ ਹਨ